ਜਦੋਂ ਅਸੀਂ ਛੋਟੇ ਹੁੰਦੇ ਸੀ ਉਦੋਂ ਸਾਡੇ ਪਿੰਡ ਵਿੱਚ ਹਰ ਘਰ ਦੇ ਵਿੱਚ ਖੂਹ ਹੁੰਦਾ ਸੀ ਅਸੀਂ ਬਾਲਟੀ ਭਰਦੇ ਸੀ ਬਾਲਟੀ ਨਾਲ ਰੱਸੀ ਬੰਨ ਕੇ ਬਾਲਟੀ ਖੂਹ ਵਿੱਚ ਸੁੱਟਦੇ ਸੀ ਅਤੇ ਰੱਸੀ ਨੂੰ ਖਿੱਚਦੇ ਸੀ ਅਤੇ ਪਾਣੀ ਕੱਢ ਕੇ ਅਸੀਂ ਘਰ ਦਾ ਕੰਮ ਕਰਦੇ ਸੀ ਸਫ਼ਾਈਆਂ ਕਰਦੇ ਸੀ ਭਾਂਡੇ ਮਾਂਜਦੇ ਸੀ ਕੱਪੜੇ ਧੋਂਦੇ ਸੀ ਨਹਾਉਂਦੇ ਸੀ ਸਾਰਾ ਕੰਮ ਖੂਹ 'ਤੇ ਹੁੰਦਾ ਸੀ ਪਰ ਲੇਕਿਨ ਉਸ ਤੋਂ ਬਾਅਦ ਜਿਉਂ ਜਿਉਂ ਦੁਨੀਆ 'ਤੇ ਤਰੱਕੀਆਂ ਹੁੰਦੀਆਂ ਗਈਆਂ ਜਦੋਂ ਪਾਣੀ ਤਰੱਕੀਆਂ ਹੁੰਦੀਆਂ ਗਈਆਂ ਉਦੋਂ ਮੋਟਰਾਂ ਲੱਗ ਗਈਆਂ ਟੈਂਕੀਆਂ ਵੀ ਲੱਗ ਗਈਆਂ ਹੁਣ ਖੂਹਾਂ ਦਾ ਕੰਮ ਸਿਰਫ਼ ਪਾਣੀ ਤੱਕ ਸੀਮਤ ਹੋ ਗਿਆ ਕਿ ਉਹ ਤੇ ਵੀ ਖੂਹ ਜਿਹੜੇ ਹੁਣ ਅੱਜ ਕੱਲ੍ਹ ਦਿਸਦੇ ਹਨ ਅਤੇ ਉਹ ਸਿਰਫ਼ ਕਿੱਥੇ ਹੁੰਦੇ ਹਨ ਜਿੱਥੇ ਕਿ ਖੇਤੀਬਾੜੀ ਹੁੰਦੀ ਹੈ ਜਿਵੇਂ ਕਿ ਉੱਥੇ ਉਹਨਾਂ ਨੇ ਮੋਟਰਾਂ ਲਾਈਆਂ ਹੁੰਦੀਆਂ ਨੇ ਅਤੇ ਮੋਟਰਾਂ ਲਾ ਕੇ ਉੱਥੇ ਟੈਂਕੀਆਂ ਭਰ ਕੇ ਰੱਖੀਆਂ ਹੁੰਦੀਆਂ ਨੇ ਘਰ ਵੀ ਟੈਂਕੀਆਂ ਭਰੀਆਂ ਹੁੰਦੀਆਂ ਨੇ ਅਤੇ ਅਸੀਂ ਮੋਟਰਾਂ ਦੀ ਵਰਤੋਂ ਇਲੈਕਟਿੰਗ ਮੋਟਰ ਦੀ ਵਰਤੋਂ ਕਰ ਲੈਂਦੇ ਹਾਂ ਤਾਂ ਕਿ ਅੱਗੇ ਆਪਾਂ ਪਾਣੀ ਭਰ ਕੇ ਨਹੀਂ ਰੱਖ ਸਕਦੇ ਸੀ ਹੁਣ ਤਾਂ ਸਾਡੇ ਕੋਲ ਖੁੱਲ੍ਹਾ ਪਾਣੀ ਜਦੋਂ ਮਰਜ਼ੀ ਇਲੈਕਟ੍ਰੋਨਿਕ ਰਾਹੀਂ ਅਸੀਂ ਛੱਡੀਏ ਅਤੇ ਅਸੀਂ ਪਾਣੀ ਭਰ ਲਈਏ ਅੱਗੇ ਖੇਤਾਂ ਦੇ ਵਿੱਚ ਪਾਣੀ ਜਿਹੜਾ ਸੀ ਉਹ ਖੂਹਾਂ ਦਾ ਆਉਂਦਾ ਸੀ ਹੁਣ ਇਲੈਕਟ੍ਰੋਨਿਕ ਮੋਟਰਾਂ ਲੱਗੀਆਂ ਹੁੰਦੀਆਂ ਨੇ ਖੂਹ ਟਿਊਬਵੈਲ ਭਰੇ ਹੀ ਹੁੰਦੇ ਹਨ ਟਿਊਬਵੈਲ ਤੋਂ ਪਾਣੀ ਉੱਥੋਂ ਹੀ ਦਿੱਤਾ ਜਾਂਦਾ ਤਾਂ ਕਿ ਫ਼ਸਲਾਂ ਦੀ ਸਿੰਚਾਈ ਚੰਗੀ ਹੋ ਸਕੇ